ਜਿਵੇਂ ਕਿ ਤੁਹਾਨੂੰ ਪਤਾ ਹੀ ਅੱ ਪਤਾ ਹੀ ਹੈ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਉਹ ਇੰਟਰਨੈਟ ਦਾ ਜ਼ਮਾਨਾ ਹੈ ਹਰ ਘਰ ਵਿੱਚ ਇੰਟਰਨੈਟ ਦੀ ਮੌਜੂਦਗੀ ਇਸ ਵੇਲੇ ਹੈ ਅਤੇ ਜਿਹੜਾ ਹਰ ਘਰ ਦਾ ਜਿਹੜਾ ਬੱਚਾ ਹੈ ਉਹ ਇੰਟਰਨੈਟ ਦੀ ਵਰਤੋਂ ਕਰਦਾ ਹੈ ਬਲਕਿ ਹਰ ਸ਼ਖਸ ਜਿਹੜਾ ਹੈ ਹਰ ਮੈਂਬਰ ਆ ਜਿਹੜਾ ਘਰ ਦਾ ਉਹ ਇੰਟਰਨੈਟ ਦੀ ਵਰਤੋਂ ਕਰਦਾ ਹੈ ਪੁਰਾਣੇ ਜ਼ਮਾਨੇ ਵਿੱਚ ਜਿਹੜੀ ਇੰਟਰਨੈਟ ਦੀ ਇੰਨੀ ਇੰਨੀ ਯੂਜਿਸ ਨਹੀਂ ਸੀ ਇੰਨੀ ਵਰਤੋਂ ਨਹੀਂ ਸੀ ਜਿਸ ਕਾਰਨ ਜਿਹੜੇ ਆਹਾ ਲੋਕ ਸੀ ਉਹ ਆਪਣਾ ਟਾਈਮ ਪਾਸਟ ਜਾਂ ਕਹਿ ਲਓ ਫਰੀ ਟਾਈਮ ਹੈ ਉਹ ਬਾਕੀ ਕੰਮਾਂ ਵਿੱਚ ਯੂਜ ਕਰਦੇ ਸੀ ਜਿਵੇਂ ਵੱਡੇ ਆਪਣੇ ਘਰ ਦੇ ਕੰਮਾਂ ਜਾਂ ਬਾਹਰ ਸਮਾਜ ਦੇ ਕੰਮਾਂ ਵਿੱਚ ਅਤੇ ਜਿਹੜੇ ਬੱਚੇ ਆ ਉਹ ਖੇਡਣ ਵਿੱਚ ਖੇਡਣ ਜਾਂ ਖੇਡਣ ਕਹਿ ਲਉ ਉਹਦੇ ਵਿੱਚ ਲੇਕਿਨ ਇੰਟਰਨੈਟ ਆਉਣ ਤੋਂ ਬਾਅਦ ਜਿਹੜਾ ਜਿਹੜੇ ਬਾਹਰ ਜਿਵੇਂ ਜਿਹੜੇ ਲੋਕ ਬੱਚੇ ਖੇਡਦੇ ਸੀ ਉਹ ਬਾਹਰ ਖ ਬਾਹਰੀ ਖੇਡਾਂ ਦੀ ਜਿਹੜੀ ਜਗ੍ਹਾ ਹੈ ਉਹ ਮੋਬਾਈਲ ਨੇ ਲੈ ਲਈ ਹੈ ਜਿਹੜੇ ਅੱਜ ਕੱਲ੍ਹ ਜਿਹੜੇ ਬੱਚੇ ਹੈ ਉਹ ਮੋਬਾਈਲ 'ਤੇ ਆਪਦਾ ਟਾਈਮ ਜ਼ਿਆਦਾ ਆਹਾ ਸਪੈਂਡ ਕਰਦੇ ਹਨ ਜ਼ਿਆਦਾ ਬਤੀਤ ਕਰਦੇ ਹਨ ਅਤੇ ਉਹ ਮੋਬਾਈਲ ਵਿੱਚ ਹੀ ਗੇਮਾਂ ਖੇਡਦੇ ਹਨ ਉਹ ਸਾਰਾ ਦਿਨ ਆਪਣੇ ਉਹੀ ਵੀਡੀਓ ਗੇਮਸ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਹਨ ਅਤੇ ਜਿਸ ਕਾਰਨ ਉਹਨਾਂ ਦੀ ਜਿਹੜੀ ਫਿਜੀਕਲ ਐਕਟੀਵਿਟੀ ਹੈ ਉਹ ਬਹੁਤ ਹੱਦ ਤੱਕ ਘੱਟ ਗਈ ਹੈ ਬਹੁਤ ਹੀ ਜ਼ਿਆਦਾ ਘੱਟ ਗਈ ਹੈ ਬੱਚੇ ਬਾਹਰ ਜਾ ਕੇ ਖੇਡਣਾ ਬਿਲਕੁਲ ਪਸੰਦ ਨਹੀਂ ਕਰਦੇ ਜਿਸ ਕਾਰਨ ਉਹਨਾਂ ਦੀ ਕੋਈ ਸਰੀਰਿਕ ਜਿਹੜੀ ਮੂਵਮੈਂਟ ਹੈ ਉਹ ਨਹੀਂ ਹੋ ਪਾਉਂਦੀ ਜਿਸ ਕਾਰਨ ਉਹਨਾਂ ਨੂੰ ਬਿਮ ਜਿਹੜੀ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਇੱਕ ਸਭ ਤੋਂ ਕੋਮਨ ਹੈ ਓਬੈਸਟੀ ਮਤਲਬ ਜਿਹੜਾ ਆਪਣਾ ਆਹਾ ਸਰੀਰ ਦਾ ਭਾਰ ਹੈ ਉਹ ਆਪਾਂ ਲੋੜ ਤੋਂ ਜ਼ਿਆਦਾ ਹੋਣ ਕਾਰਨ ਜਿਹੜਾ ਮੋਟਾਪਾ ਆਉਣ ਕਾਰਨ ਜਿਹੜੀ ਆਪਾਂ ਨੂੰ ਬਹੁਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਾਂ ਇਸ ਨਾਲ ਲੜ ਸਕਦੇ ਹਾਂ ਜਿਵੇਂ ਆਪਾਂ ਕੋਈ ਬਾਹਰਲੀ ਖੇਡ ਖੇਡ ਸਕਦੇ ਹਾਂ ਜਿਵੇਂ ਕੋਈ ਆਹਾ ਚਿੜੀ ਛਿੱਕਾ ਹੋ ਗਿਆ ਜਾਂ ਕ੍ਰਿਕਟ ਹੋ ਗਿਆ ਜਾਂ ਭੱਜਣਾ ਹੋ ਸਿੰਪਲ ਭੱਜਣਾ ਤੁਰਨਾ ਆਪਾਂ ਨੂੰ ਕਾਫੀ ਇਸ ਚੀਜ਼ 'ਚ ਮਦਦ ਕਰਦਾ ਹੈ ਲੇਕਿਨ ਜਿਹੜੇ ਅੱਜ ਕੱਲ੍ਹ ਦੇ ਬੱਚੇ ਹੈ ਉਹ ਇੰਨਾ ਕੁਝ ਕਰਨ ਵਿੱਚ ਵੀ ਬਿਲਕੁਲ ਇੰਟਰਸਟਡ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਫਿਜੀਕਲ ਐਕ ਆਹ ਜਿਹੜੀ ਡਸਿਸਜ ਹੈ ਬਿਮਾਰੀਆਂ ਉਹਨਾਂ ਦਾ ਸਾਹਮਣਾ ਬਹੁਤ ਛੋਟੀ ਉਮਰ ਵਿੱਚ ਹੀ ਕਰਨਾ ਪੈਂਦਾ ਹੈ ਆਪਾਂ ਨੂੰ ਇਸ ਇਸ ਦਿੱਕਤ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਬੱਚੇ ਐਂ ਛੋਟੀ ਉਮਰ ਵਿੱਚ ਬਿਮਾਰ ਹੁੰਦੇ ਰਹੇ ਤਾਂ ਉਹ ਵੱਡ ਆਪਣਾ ਸਮਾਜ ਅਤੇ ਆਪਣੇ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਖਰਾਬ ਹੋ ਜਾਵੇਗਾ ਧੰਨਵਾਦ